ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਉਹ ਪਤਾ ਕਰਨਾ ਸੀ ਨਾ ਅਸੀਂ ਘੁੰਮਣ ਆਉਣਾ ਜੀ ਬਠਿੰਡੇ ਤੇ ਕੋਈ ਜਗ੍ਹਾ ਜੀ ਘੁੰਮਣ ਲਈ ਹਾਂਜੀ ਠੀਕ ਹੈ ਜੀ ਇੱਕ ਮੈਂ ਨਾ ਬਾਏ ਟਰੇਨ ਆਊਂਗਾ ਤਾਂ ਫਿਰ ਮੈਂ ਕਿੱਧਰ ਦੀ ਆਵਾਂ ਜਾਂ ਕਿਵੇਂ ਕਿੰਨਾ ਕੁ ਟਾਈਮ ਲੱਗੂ ਉੱਥੋਂ ਕੀ ਮਿਲੂਗਾ ਮੈਨੂੰ ਅੱਛਾ ਜੀ ਉੱਥੋਂ ਆਟੋ ਮਿਲ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਹੋਰ ਕੋਈ ਜਗ੍ਹਾ ਹੈ ਜੀ ਉੱਥੇ ਆਸ ਪਾਸ ਠੀਕ ਹੈ ਉੱਥੋਂ ਕਿ ਪੈਦਲ ਹੀ ਜਾ ਸਕਦੇ ਨਜ਼ਦੀਕ ਹੈ ਜਾਂ ਕੋਈ ਉੱਥੋਂ ਦੀ ਆਟੋ ਲੈਣਾ ਪਊਗਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਮ ਧੰਨਵਾਦ ਓਕੇ